ਹੈਲੋ ਸਰ ਮੈਂ ਤੁਹਾਡੀ ਟਰੈਵਲ ਏਜੰਸੀ ਤੋਂ ਔਨਲਾਈਨ ਕੈਬ ਬੁੱਕ ਕੀਤੀ ਸੀ ਔਫਿਸ ਮੀਟਿੰਗ ਲਈ ਅਤੇ ਤੁਹਾਡੀ ਜਿਹੜੀ ਕੈਬ ਟਾਈਮਿੰਗ ਕੈਬ ਦੀ ਜਿਹੜੀ ਟਾਈਮ ਦਿੱਤਾ ਸੀ ਉਹ ਸਮੇਂ ਸਿਰ ਨਹੀਂ ਪਹੁੰਚੀ ਅਤੇ ਮੇਰੀ ਫਲਾਈਟ ਵੀ ਮਿਸ ਹੋ ਗਈ ਅਤੇ ਮੇਰੀ ਫਲਾਈਟ ਮਿਸ ਹੋਣ ਕਰਕੇ ਜਿਹੜੀ ਮੇਰੀ ਬਿਜਨਸ ਮੀਟਿੰਗ ਸੀ ਉਹ ਵੀ ਮੈਂ ਅਟੈਂਡ ਨਹੀਂ ਕਰ ਸਕੀ ਹੈਗੀ ਅਤੇ ਜਿਹੜੇ ਮੈਨੂੰ ਸੀ ਜਿਹੜੇ ਮੇਰੇ ਸੀਨੀਅਰ ਹੈਗੇ ਆ ਔਫਿਸ ਦੇ ਸਟਾਫ ਵਿੱਚ ਉਹਨਾਂ ਵੱਲੋਂ ਮੈਨੂੰ ਜਿਹੜੀ ਵੋਰਨਿੰਗ ਦਿੱਤੀ ਗਈ ਆ ਕਿ ਜੇਕਰ ਤੁਸੀਂ ਅੱਗੇ ਤੋਂ ਕੋਈ ਵੀ ਸਾਡੀ ਮੀਟਿੰਗ ਮਿਸ ਕੀਤੀ ਤਾਂ ਤੁਹਾਡੀ ਜੋਬ ਨੂੰ ਤੁਹਾਨੂੰ ਜੋਬ ਤੋਂ ਨਿਕਾਲ ਦਿੱਤਾ ਜਾਏਗਾ ਜਿਹਦੇ ਕਰਕੇ ਮੇਰੀ ਜੋਬ ਵੀ ਖ਼ਤਰੇ 'ਚ ਹੈਗੀ ਆ ਤੇ ਇਹ ਜਿਹੜੀ ਗਲਤੀ ਸਿਰਫ਼ ਤੁਹਾਡੀ ਕੈਬ ਡਰਾਈਵਰ ਕਰਕੇ ਹੋਈ ਉਹਦੇ ਸਮੇਂ ਸਿਰ ਨਾ ਪਹੁੰਚਣ ਕਰਕੇ ਅਤੇ ਕਿਉਂਕਿ ਜੇ ਉਹ ਸਮੇਂ ਸਿਰ ਪਹੁੰਚ ਜਾਂਦਾ ਤਾਂ ਮੈਂ ਆਪਣੀ ਫਲਾਈਟ ਦੇ ਰਾਹੀਂ ਜਿਹੜੀ ਔਫਿਸ ਮੀਟਿੰਗ ਅਟੈਂਡ ਕਰ ਲੈਣੀ ਸੀ ਅਤੇ ਹੁਣ ਜਿਹੜਾ ਤੁਹਾਡਾ ਡਰਾਈਵਰ ਆ ਅਤੇ ਮੈਂ ਉਹਨੂੰ ਵੀ ਪੇਮੈਂਟ ਨਹੀਂ ਦੇਣੀ ਹੈਗੀ ਅਤੇ ਜਿਹੜੀ ਮੇਰੀ ਹਵਾਈ ਯਾਤਰਾ ਦਾ ਟਿਕਟ ਦਾ ਖਰਚਾ ਆਇਆ ਸੀ ਅਤੇ ਉਹ ਵੀ ਤੁਹਾਨੂੰ ਮੈਨੂੰ ਰਿਫੰਡ ਦੇਣਾ ਚਾਹੀਦਾ ਕਿਉਂਕਿ ਜੋ ਕੁਝ ਵੀ ਹੋਇਆ ਤੁਹਾਡੀ ਲਾਪਰਵਾਹੀ ਕਰਕੇ ਹੋਇਆ ਅਤੇ ਮੈਂ ਤੁਹਾਡੀ ਜਿਹੜੀ ਸਰਵਿਸ ਤੋਂ ਬਿਲਕੁਲ ਸੈਟਿਸਫਾਈ ਨਹੀਂ ਹੈਗੀ